ਹਾਂ ਭੰਗੜਾ ਐਰੋਬਿਕਸ ਭਵਿੱਖ ਵਿੱਚ ਬਹੁਤ ਪ੍ਰਸਿੱਧ ਹੋਵੇਗਾ ਕਿਉਂਕਿ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਈਵਨ ਕਿ ਹੁਣ ਸਮਝ ਲਓ ਤੁਸੀਂ ਜਿਸ ਤਰ੍ਹਾਂ ਹੁਣ ਭੰਗੜਾ ਤੁਸੀਂ ਭੰਗੜਾ ਕਰਦੇ ਹੋ ਤੁਹਾਡੇ ਕੋਈ ਸਰੀਰ 'ਚ ਕਿਤੇ ਦਰਦ ਹੁੰਦੀ ਤੁਸੀਂ ਥੋੜ੍ਹੀ ਦੇਰ ਭੰਗੜਾ ਕਰੋਗੇ ਤੁਹਾਡਾ ਸਰੀਰ ਥੋੜ੍ਹੀ ਹੌਲੀ ਹੌਲੀ ਹੌਲੀ ਹੌਲੀ ਮੂਵ ਕਰੇਗਾ ਅਤੇ ਤੁਸੀਂ ਜਿਸ ਤਰ੍ਹਾਂ ਹੁਣ ਭੰਗੜਾ ਕਰੋਗੇ ਤੁਸੀਂ ਜਿੰਮ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਜਿੰਮ ਕਿਉਂਕਿ ਘਰ ਮਿਊਜਿਕ ਲਗਾਓ ਕੋਈ ਅੱਛਾ ਗਾਣਾ ਲਗਾਓ ਜਿਹਦੇ ਨਾਲ ਤੁਹਾਡੇ ਸਰੀਰ 'ਚ ਐਨਰਜੀ ਆਵੇ ਅਤੇ ਤੁਸੀਂ ਭੰਗੜਾ ਕਰੋ ਭੰਗੜਾ ਸਾਰੇ ਸਰੀਰ ਦੀ ਐਕਸਰਸਾਈਜ਼ ਕਰ ਦਿੰਦਾ ਭੰਗੜੇ ਨਾਲ ਸਰੀਰ ਦੀ ਇੱਕ ਇੱਕ ਅੰਗ ਦੀ ਮੂਵਮੈਂਟ ਹੁੰਦੀ ਹੈ ਅਤੇ ਸਾਰੇ ਸਰੀਰ ਵਿੱਚ ਐਨਰਜੀ ਆ ਜਾਂਦੀ ਭੰਗੜਾ ਹੁਣ ਕਿਤੇ ਵਿਆਹਾਂ ਸ਼ਾਦੀਆਂ 'ਤੇ ਜਾਓ ਤੁਸੀਂ ਜੇ ਕੋਈ ਕਹੇਗਾ ਵੀ ਨਾ ਕਿਸੇ ਨੂੰ ਉਠਾਲ ਕੇ ਬਿਠਾ ਲਉ ਖਿੱਚੋ ਤੁਸੀਂ ਵੀ ਤੁਸੀਂ ਭੰਗੜਾ ਪਾਓ ਆਓ ਕਹੇਗਾ ਮੇਰੇ ਗੋਡੇ ਦੁੱਖਦੇ ਥੋੜ੍ਹੀ ਦੇਰ ਨੱਚੇਗਾ ਉਹ ਅਤੇ ਆਪਣੇ ਆਪ ਗੋਡਿਆਂ ਦੇ ਦਰਦ ਦੂਰ ਹੋ ਜਾਂਦੇ ਮੇਰਾ ਆਪਣਾ ਹੀ ਇੱਦਾਂ ਹੀ ਇਹੀ ਹਾਲ ਹੈ ਜਦੋਂ ਮੈਂ ਕਿਸੀ ਵਿਆਹ ਸ਼ਾਦੀ ਜਾਂਦੀ ਮੈਂ ਕਹਿੰਦੀ ਨਹੀਂ ਮੈਂ ਨੱਚਣਾ ਨਹੀਂ ਹੈਗਾ ਅਤੇ ਨੱਚਣ ਕਰਕੇ ਭੰਗੜਾ ਪਾਉਣ ਕਰਕੇ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਇੱਕ ਟੈਨਸ਼ਨ ਮੁਕਤ ਹੋ ਜਾਂਦੇ ਪਿੱਛੇ ਦੇ ਦੁੱਖ ਦਰਦ ਕਿਆ ਸਰੀਰ ਦਾ ਸਾਰਾ ਹੀ ਭੁੱਲ ਜਾਂਦਾ ਇੱਕ ਵਾਰੀ ਭੰਗੜਾ ਕਰਨਾ ਸ਼ੁਰੂ ਕਰ ਦਿਉ ਸਾਰੇ ਸਰੀਰ ਵਿੱਚ ਐਨਰਜੀ ਆ ਜਾਂਦੀ ਅਤੇ ਸਰੀਰ ਚੁਸਤ ਫੁਰਤ ਹੋ ਜਾਂਦਾ ਧੰਨਵਾਦ